ਧਰਮ ਸਾਡੇ ਖੇਤਰ ਦੇ ਵਿੱਚ ਰੋਜ਼ਾਨਾ ਰਾ ਰਲ਼ ਮਿਲ ਕੇ ਰ ਰਹਿਣ ਲਈ ਦੱਸਦਾ ਹੈ ਅਤੇ ਸੱਚ ਲਈ ਵੀ ਦੱਸਦਾ ਹੈ ਅਤੇ ਰਲ਼ ਮਿਲ ਕੇ ਰਹਿਣ ਲਈ ਵੀ ਦੱਸਦਾ ਹੈ ਅਤੇ ਦੂਜਿਆਂ ਦੀ ਮਦਦ ਕਰਨ ਵਾਸਤੇ ਵੀ ਦੱਸਦਾ ਹੈ ਅਤੇ ਆਪਸੀ ਮਤਭੇਦ ਨੂੰ ਦੂਰ ਕਰਨ ਲਈ ਦੱਸਦਾ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੇ ਰੋਜ਼ਾਨਾ ਦੇ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਅਤੇ ਉਹਨਾਂ ਬਾਰੇ ਵੀ ਦੱਸਦੇ ਹੈ ਦੱਸਦਾ ਹੈ